ਪੰਜਾਬੀ ਭਾਸ਼ਾ ਵਿੱਚ ਸਹਿਯੋਗ ਕੀ ਤੁਹਾਨੂੰ ਅੱਜ ਮੈਂ ਦੱਸਣਾ ਚਾਹੁੰਦਾ ਹਾਂ ਸਾਰਿਆਂ ਤੋਂ ਪਹਿਲੋਂ ਹੈਗਾ ਹੀ ਵੀ ਮਾਮਾ ਜਿਵੇਂ ਆਪਾਂ ਕਿਸੇ ਵੀ ਆਪਣੇ ਯਾਰ ਵੇਲੀ ਨਾਲ ਬੈਠੇ ਹੋਈਏ ਜਾਂ ਖੇਡਣ ਦੀ ਹੋਈਏ ਕੋਈ ਵੀ ਗੱਲ ਹੋ ਜਾਵੇ ਉਹਦੇ ਵਿੱਚ ਉਨ ਅਸੀਂ ਉਹਨੂੰ ਕਹਿੰਦੇ ਨਹੀਂ ਮਾਮਾ ਇੱਦਾਂ ਨਹੀਂ ਕਰਨਾ ਇੱਦਾਂ ਹੀ ਨਹੀਂ ਮਾਮਾ ਜੇ ਨਹੀਂ ਉੱਥੇ ਚੱਲੀਏ ਆਜਾ ਇੱਦਾਂ ਅਤੇ ਦੂਜਾ ਸ਼ਬਦ ਹੈਗਾ ਵੀ ਟੈਂਸ਼ਨ ਨਾ ਲੈ ਜਿਵੇਂ ਕੋਈ ਵੀ ਹੋ ਜਾਂਦਾ ਵੀ ਆਪਾਂ ਯਾਰ ਵੇਲੀ ਦੋ ਜਾਣੇ ਇਕੱਠੇ ਘੁੰਮ ਆਉਂਦੇ ਵੇ ਆਪਾਂ ਉਹਨੂੰ ਕਹਿੰਦੇ ਹਾਂ ਵੀ ਆਜਾ ਅੱਜ ਕੋਈ ਨਹੀਂ ਟੈਂਸ਼ਨ ਨਾ ਲੈ ਮੈਂ ਵੀ ਹੈਗਾ ਤੇਰੇ ਨਾਲ ਤੀਜਾ ਹੈਗਾ ਬਿੱਜੂ ਜਿਵੇਂ ਕੋਈ ਵੀ ਪਿੰਡ ਦੇ ਵਿੱਚ ਕੋਈ ਵੀ ਬੈਠਾ ਹੁੰਦਾ ਸਧਾਰਨ ਜਿਹਾ ਬਣ ਕੇ ਕੋਈ ਆਮ ਜਿੱਦਾਂ ਚੌਂਕੜੀ ਮਾਰ ਕੇ ਉੱਥੇ ਬੈਠਾ ਹੁੰਦਾ ਥੋੜ੍ਹਾ ਜਿਹਾ ਗੁੱਸ ਗੁੱਸਾ ਹੁੰਦਾ ਜਾਂ ਉਹਨੂੰ ਟੈਂਸ਼ਨ ਹੁੰਦੀ ਤਾਂ ਅਸੀਂ ਓਦਾਂ ਹੀ ਵੈਸੇ ਮਜ਼ਾਕ ਦੇ ਵਿੱਚ ਕਹਿ ਦਿੰਦੇ ਹਾਂ ਵੀ ਆਹ ਬਿੱਜੂ ਜਿਹਾ ਬੈਠਾ ਹੈ ਅਤੇ ਤੀਜਾ ਅੱਛਾ ਵੀ ਆੜੀ ਜਿਵੇਂ ਆਪਾਂ ਆਪਣੇ ਯਾਰ ਦੋਸਤ ਨੂੰ ਪਾ ਜਿਹਨੂੰ ਕਹਿੰਦੇ ਵੀ ਆਪਣਾ ਦੋਸਤ ਹੋਵੇ ਤਾਂ ਉਹਨੂੰ ਕਹਿ ਦਿੰਦਾ ਵੀ ਆਹ ਪਿਆਰ ਨਾਲ ਨੰਘਣਾ ਵਾ ਓ ਜਾ ਤੇਰਾ ਆੜੀ ਆ ਗਿਆ ਜਾ ਉਹਦੇ ਨਾਲ ਚੱਲ ਜਾ ਉੱਥੇ ਤ ਚੋ ਪੰਜਵਾਂ ਸ਼ਬਦ ਹੈਗਾ ਔਖਾ ਕਿਉਂ ਬੋਲਦਾ ਵੈਸੇ ਹੀ ਉਦਾਂ ਹੀ ਮਜ਼ਾਕ ਦੇ ਵਿੱਚ ਕੋਈ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ ਅਤੇ ਦੂਜਾ ਬੰਦਾ ਇਹਦਾ ਯਾਰ ਤੁਹਾਡਾ ਉਦਾਂ ਹੀ ਬੋਲ ਪਏ ਤੁਸੀਂ ਕਹਿਣਾ ਤੁਸੀਂ ਮਜ਼ਾਕ ਮਜ਼ਾਕ ਦੇ ਵਿੱਚ ਉਹਨੂੰ ਕਹਿ ਦਿੰਦੇ ਹਾਂ ਔਖਾ ਕਿਉਂ ਬੋਲਣ ਡਿਆ ਅਰਮਾਨ ਨਾਲ ਬੋਲ ਇਹੋ ਸ਼ਬਦ ਹੈਗੇ ਪੰਜਾਬੀ ਭਾਸ਼ਾ ਦੀ ਸ਼ਬਦ ਅਤੇ ਜੋ ਸਧਾਰਨ ਸ਼ਬਦ ਹਨ